ਪੰਜਾਬ ਵਿੱਚ ਅੱਜ ਕੱਲ੍ਹ ਇਹ ਚੀਜ਼ਾਂ ਨੂੰ ਬਹੁਤ ਸੀਰੀਅਸਲੀ ਲਿੱਤਾ ਜਾਂਦਾ ਹੈ ਜਿਵੇਂ ਕਿ ਥਾਂ ਥਾਂ 'ਤੇ ਜਗ੍ਹਾ ਜਗ੍ਹਾ 'ਤੇ ਸੈਂਟਰ ਬਣੇ ਹੋਏ ਹਨ ਜਿੱਥੇ ਲੋਕ ਜਾਂਦੇ ਹਨ ਜਿਹੜੇ ਇਸ ਜ ਚੀਜ਼ਾਂ ਨਾਲ ਡੀਲ ਕਰਦੇ ਹਨ ਮਾਨਸਿਕ ਸਿਹਤ ਉਹਨਾਂ ਦੀ ਠੀਕ ਨਹੀਂ ਹੈ ਮਾਨਸਿਕ ਸਿਹਤ ਠੀਕ ਨਹੀਂ ਆ ਉਹਨਾਂ ਦੀ ਉਹ ਜਿਹੜੇ ਇਹਨਾਂ ਚੀਜ਼ਾਂ ਨਾਲ ਡੀਲ ਕਰਦੇ ਹਨ ਉਹ ਉੱਥੇ ਸੈਂਟਰਸ 'ਚ ਜਾ ਕੇ ਰਹਿੰਦੇ ਹਨ ਉੱਥੋਂ ਦੇ ਲੋਕ ਉਹਨਾਂ ਨੂੰ ਦੱਸਦੇ ਹਨ ਕਿ ਕਿਵੇਂ ਉਹ ਇਹਨਾਂ ਚੀਜ਼ਾਂ ਨਾਲ ਡੀਲ ਕਰਨ ਅਤੇ ਕਿਵੇਂ ਉਹ ਖੁਸ਼ ਰਹਿ ਸਕਦੇ ਹਨ ਕਿਤੇ ਕਿਤੇ ਤਾਂ ਇਹ ਸੈਂਟਰ ਫਰੀ ਹੀ ਹਨ ਉਹ ਸੈਂਟਰ ਵਾਲੇ ਇਹਨਾਂ ਨੂੰ ਬਹੁਤ ਕੁਝ ਸਿਖਾਉਂਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਦੀ ਨ ਖੁਸ਼ ਰਹਿ ਸਕਦੇ ਹਨ ਉਹਨਾਂ ਦੀ ਥੈਰੀਪੀ ਕੀਤੀ ਜਾਂਦੀ ਹੈ ਉਹਨਾਂ ਦਾ ਇਲਾਜ ਬਹੁਤ ਵਧੀਆ ਤਰੀਕੇ ਨਾਲ ਕੀਤੇ ਜਾਂਦਾ ਹੈ ਜਿਹੜੇ ਸੈਂਟਰ ਫਰੀ ਹੁੰਦੇ ਹਨ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਇਲਾਜ ਕਰਦੇ ਹਨ ਉੱਥੇ ਸਾਰੀਆਂ ਉਹਨਾਂ ਨੂੰ ਸਹੂਲਤਾਂ ਉਪਲੱਬਧ ਹੁੰਦੀਆਂ ਹਨ ਉਹਨਾਂ ਲੋਕਾਂ ਨੂੰ ਕੋਈ ਤਕਲੀਫ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਹ ਸੈਂਟਰ ਬਹੁਤ ਲਾਭਕਾਰੀ ਹੁੰਦੇ ਹਨ ਇਹ ਸਾਰੇ ਦੇਸ਼ ਵਿੱਚ ਜਗ੍ਹਾ ਜਗ੍ਹਾ 'ਤੇ ਬਣੇ ਹੁੰਦੇ ਹਨ ਜਿਹਨਾਂ ਨਾਲ ਲੋਕ ਆਪਣੇ ਡਿਪਰੈਸ਼ਨ ਤੋਂ ਬਚ ਦੂਰ ਹੁ ਬਚਦੇ ਹਨ ਅਤੇ ਲੋਕ ਰਿਲੈਕਸ ਫੀਲ ਕਰਦੇ ਹਨ